ਕੋਵਿਡ ਇੱਕ ਬਿਮਾਰੀ ਜਿਹੜੀ ਦੋ ਹਜਾਰ ਵੀਹ ਵਿੱਚ ਆਈ ਤੇ ਉਹਨੇ ਦੁਨੀਆਂ ਜਿਵੇਂ ਰੋਕ ਹੀ ਦਿੱਤੀ ਇਸ ਕਾਰਨ ਸਾਰੀ ਦੁਨੀਆ ਚ ਲੋਕਡਾਊਨ ਹੋ ਗਿਆ ਜਿਸ ਕਾਰਨ ਦੋ ਸਾਲ ਲਈ ਸਾਰੇ ਕੰਮ ਕਰਨ ਵਾਲੀਆਂ ਥਾਵਾਂ ਸਕੂਲ ਕਾਲਜ ਸਾਰਾ ਬੰਦ ਹੋ ਗਿਆ ਪਰ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ ਤਾਂ ਇਸ ਵਿੱਚ ਮੋਬਾਇਲ ਫੋਨ ਨੇ ਬਹੁਤ ਮਦਦ ਕੀਤੀ ਅਧਿਆਪਕ ਬੱਚਿਆਂ ਦੀ ਆਨਲਾਈਨ ਕਲਾਸ ਲੈਂਦੇ ਸਨ ਤੇ ਉਹਨਾਂ ਦੀ ਪ੍ਰੀਖਿਆ ਵੀ ਆਨਲਾਈਨ ਹੀ ਹੁੰਦੀ ਸੀ ਇਸ ਕਾਰਨ ਬੱਚਿਆਂ ਦੀ ਪੜ੍ਹਾਈ ਦਾ ਇੰਨਾ ਕੋਈ ਨੁਕਸਾਨ ਨਹੀਂ ਹੋਇਆ ਪਰ ਜਿਵੇਂ ਕੀ ਕਹਿੰਦੇ ਹਨ ਕਿ ਕਿਸੇ ਚੀਜ਼ ਦੇ ਅਗਰ ਫਾਇਦੇ ਹਨ ਤੇ ਉਹਨਾਂ ਦੇ ਨੁਕਸਾਨ ਵੀ ਹੁੰਦੇ ਹਨ ਇਨੇ ਬੱਚਿਆਂ ਨੇ ਫੋਨ ਦੀ ਲੱਤ ਲਗਾ ਦਿੱਤੀ ਜਿਸ ਕਾਰਨ ਹੁਣ ਬੱਚੇ ਪੜ੍ਹਾਈ ਵਿੱਚ ਬਿਲਕੁਲ ਧਿਆਨ ਨਹੀਂ ਦੇ ਰਹੇ ਤੇ ਸਿਰਫ ਆਪਣਾ ਫੋਨ ਚਲਾ ਕੇ ਫਾਲਤੂ ਦੇ ਵਿੱਚ ਆਪਣਾ ਵਕਤ ਖਰਾਬ ਕਰ ਰਹੇ ਹਨ ਤੇ ਬੱਚੇ ਜਦ ਆਨਲਾਈਨ ਪ੍ਰੀਖਿਆ ਹੁੰਦੀ ਸੀ ਤਾਂ ਉਹ ਬਿਲਕੁਲ ਵੀ ਇਮਾਨਦਾਰੀ ਨਾਲ ਪ੍ਰੀਖਿਆ ਨਹੀਂ ਦਿੰਦੇ ਸਨ ਉਹਨਾਂ ਉਹ ਆਪਣੇ ਦੋਸਤਾਂ ਨਾਲ ਫੋਨ ਤੇ ਗੱਲ ਕਰਦੇ ਕਰਦੇ ਪ੍ਰੀਖਿਆ ਦਿੰਦੇ ਸਨ ਜਿਹੜੀ ਕੀ ਹੁਣ ਨੁਕਸਾਨ ਕਰਦੀ ਪਈ ਹੈ